ਮੇਰਾ ਸਭ ਤੋਂ ਮਨਪਸੰਦ ਗੈਜਟ ਮੋਬਾਈਲ ਫੋਨ ਹੈ ਜੋ ਕਿ ਮੈਨੂੰ ਮੇਰੇ ਰੋਜ਼ਾਨਾ ਜੀਵਨ ਵਿੱਚ ਬਹੁਤ ਸਾਰੇ ਲਾਭ ਪਹੁੰਚਾਉਂਦਾ ਹੈ ਜਿਸ ਜਿੱਦਾਂ ਕਿ ਮੈਂ ਕਿਸੇ ਕਿਸੇ ਜਗ੍ਹਾ ਦੀ ਲੋਕੇਸ਼ਨ ਦਾ ਪਤਾ ਕਰ ਸਕਦੀ ਹਾਂ ਔਰ ਜਿੱਦਾਂ ਕਿ ਮੈਂ ਆਪਣੀਆਂ ਟਿਕਟਾਂ ਬੁੱਕ ਕਰ ਸਕਦੀ ਹਾਂ ਜੇਕਰ ਮੈਨੂੰ ਕਿਸੇ ਜੇ ਮੈਂਨੂੰ ਕਿਸੇ ਚੀਜ਼ ਦੀ ਜਰੂਰਤ ਹੋਵੇ ਤਾਂ ਮੈਂ ਫੋਨ ਤੇ ਆਨਲਾਈਨ ਸ਼ਾਪਿੰਗ ਐਪਸ ਤੋਂ ਚੀਜ਼ਾਂ ਘਰ ਬੈਠੇ ਮੰਗਵਾ ਸਕਦੀ ਹਾਂ ਜਿਸ ਤੇ ਮੈਨੂੰ ਸਮਾਂ ਵੀ ਘੱਟ ਲੱਗਦਾ ਹੈ ਮੋਬਾਇਲ ਫੋਨ ਦੀ ਵਰਤੋਂ ਕਰਕੇ ਮੈਂ ਆਪਣੇ ਕਿਸੇ ਵੀ ਰਿਸ਼ਤੇਦਾਰ ਨਾਲ ਘਰ ਬੈਠੇ ਸਾਹਮਣੇ ਆਮੋ ਸਾਹਮਣੇ ਬੈਠਣ ਤੋਂ ਬਿਨਾਂ ਹੀ ਫੋਨ 'ਤੇ ਗੱਲ ਕਰ ਸਕਦੀ ਆਂ ਉਹਨਾਂ ਦਾ ਹਾਲ ਚਾਲ ਪੁੱਛ ਸਕਦੀ ਹਾਂ ਮੋਬਾਇਲ ਫੋਨ ਦੁਆਰਾ ਇਹ ਮੈਨੂੰ ਬਹੁਤ ਸਾਰੇ ਲਾਭ ਪਹੁੰਚਾ ਰਿਹਾ ਹੈ ਜਿਸ ਤਰ੍ਹਾਂ ਕਿ ਮੈਂ ਕੋਈ ਕਿਸੇ ਵੀ ਖਾਣਾ ਖਾਣਾ ਬਣਾਉਂਦਾ ਤਰੀਕਾ ਸਿੱਖ ਸਕਦੀ ਹਾਂ ਇਹ ਮੋਬਾਈਲ ਫੋਨ ਮੈਨੂੰ ਮੈਨੂੰ ਸਿੱਖਿਆ ਲਈ ਵੀ ਪ੍ਰੇਰਿਤ ਸਿੱਖਿਆ ਦੇ ਵਿੱਚ ਵੀ ਯੋਗਦਾਨ ਪਾਉਂਦਾ ਹੈ ਜਿਸ ਤਰ੍ਹਾਂ ਮੈਂ ਕੋਈ ਨੌਵਲ ਨੌਵਲ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਕਹਾਣੀ ਫੋਨ ਉੱਤੇ ਪੜ ਸਕਦੀ ਹਾਂ ਮੋਬਾਇਲ ਫੋਨ ਇੱਕ ਤਰ੍ਹਾਂ ਦਾ ਗੈਜਟ ਜੋ ਕਿ ਸਭ ਦੇ ਜੀਵਨ ਵਿੱਚ ਲਾਭ ਪਹੁੰਚਾਉਂਦਾ ਹੈ ਮੋਬਾਇਲ ਫੋਨ ਦੀ ਵਰਤੋਂ ਕਰਕੇ ਮੈਂ ਇਸ ਘਰ ਬੈਠੇ ਕੋਈ ਵੀ ਚੀਜ਼ ਜਿੱਦਾਂ ਕਿ ਮੈਨੂੰ ਇੱਕੋਂ ਸਮੇਂ ਤੇ ਜਰੂਰਤ ਹੋਵੇ ਮੈਂ ਮੰਗਵਾ ਸਕਦੀ ਹਾਂ ਆਪਣੇ ਅਤੇ ਆਪਣੀ ਪਰਿਵਾਰ ਲਈ ਵੀ ਮੋਬਾਇਲ ਫੋਨ ਦੁਆਰਾ ਮੈਂ ਕਿਸੇ ਵੀ ਜਗ੍ਹਾ ਦਾ ਪਤਾ ਕਰ ਸਕਦੀ ਆਂ ਕਿਸੇ ਵੀ ਇਤਿਹਾਸਿਕ ਜਗ੍ਹਾ ਦਾ ਅਤੇ ਉਸ ਬਾਰੇ ਜਾਣਕਾਰੀ ਹਾਸਿਲ ਕਰ ਸਕਦੀ ਹਾਂ ਕਿਸੇ ਵੀ ਧਰਮ ਬਾਰੇ ਜਾਂ ਕਿਸੇ ਵੀ ਕਿਸੇ ਵੀ ਧਰਮ ਬਾਰੇ ਜਾਣਕਾਰੀ ਹਾਸਿਲ ਕਰ ਸਕਦੀ ਹਾਂ ਮੋਬਾਇਲ ਫੋਨ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਲਾਭ ਹੈ ਮੋਬਾਈਲ ਫੋਨ ਦੀ ਵਰਤੋਂ ਨਾਲ ਮੈਂ ਆਪਣੇ ਦੋਸਤਾਂ ਘਰਦਿਆਂ ਦੀ ਸਹਾਇਤਾ ਵੀ ਕਰ ਸਕਦੀ ਹਾਂ